ਹਾਂ ਮੇਰੇ ਕੋਲ ਫੋਟੋਆਂ ਦੀ ਕਈ ਪੁਰਾਣੀਆਂ ਹਾਰਡ ਕਾਪੀਆਂ ਕਲਿੱਕ ਕੀਤੀਆਂ ਗਈਆਂ ਨੇ ਜਿਵੇਂ ਪੁਰਾਣੇ ਬਜ਼ੁਰਗਾਂ ਪੁਰਾਣੇ ਸਮੇਂ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਫੋਟੋਆਂ ਖਿੱਚਣ ਦਾ ਬਹੁਤ ਸ਼ੌਕ ਸੀ ਅਤੇ ਫੋਟੋਆਂ ਪੁਰਾਣੇ ਸਮੇਂ ਵਿੱਚ ਜੋ ਅਸੀਂ ਘੁੰਮਣ ਜਾਣਾ ਕਿਤੇ ਵੀ ਉਦੋਂ ਉੱਥੇ ਫੋਟੋ ਖਿੱਚਣਾ ਅਤੇ ਇਹ ਫੋਟੋਆਂ ਅਸੀਂ ਇੱਕ ਯਾਦ ਦੇ ਤੌਰ 'ਤੇ ਹੀ ਆਪਾਂ ਖਿੱਚ ਕੇ ਰੱਖਦੇ ਸੀ ਆਪਾਂ ਹਾਂ ਪਰਾ ਜਿਹੜੀਆਂ ਪੁਰਾਣੀਆਂ ਫੋਟੋਆਂ ਨੇ ਅਤੇ ਅੱਜ ਦੀਆਂ ਨਵੀਆਂ ਫੋਟੋਆਂ ਉਸ ਵਿੱਚ ਬਹੁਤ ਸਾਰਾ ਅੰਤਰ ਦੇਖਣ ਨੂੰ ਮਿਲਿਆ ਜਿਹੜੀਆਂ ਪੁਰਾਣੀਆਂ ਫੋਟੋਆਂ ਹੁੰਦੀਆਂ ਸੀ ਉਸ ਵਿੱਚ ਇੰਨੀ ਕੁਆਲਿਟੀ ਨਹੀਂ ਹੁੰਦੀ ਸੀ ਨਾ ਹੀ ਉਹ ਡਿਜੀਟਲ ਤੌਰ 'ਤੇ ਇੰਨੀਆਂ ਵਧੀਆਂ ਹੁੰਦੀਆਂ ਸੀ ਪਰੰਤੂ ਅੱਜ ਕੱਲ੍ਹ ਜੋ ਫੋਟੋਆਂ ਨੇ ਉਹ ਜ਼ਿਆਦਾ ਐਚ ਡੀ ਕੁਆਲਿਟੀ ਵਿੱਚ ਆ ਰਹੀਆਂ ਨੇ ਇਸ ਇਹ ਦੇਖਣ ਵਿੱਚ ਕਲਰ ਬਹੁਤ ਬਰਾਈਟ ਕਲਰ ਵਰਤੋਂ ਕੀਤੀ ਜਾ ਰਹੀ ਹੈ ਇਸ ਇਹਨਾਂ ਵਿੱਚ ਅਤੇ ਜਿਹੜੀਆਂ ਪੁਰਾਣੀਆਂ ਫੋਟੋਆਂ ਹੁੰਦੀਆਂ ਸੀ ਉਹ ਜ਼ਿਆਦਾਤਰ ਬਲੈਕ ਐਡ ਵਾਈਟ ਰੂਪ ਵਿੱਚ ਜਾਂ ਗ੍ਰੇਅ ਸਕੇਲ ਦੇ ਤੌਰ 'ਤੇ ਹੀ ਖਿੱਚ ਕਲਿੱਕ ਕੀਤੀਆਂ ਜਾਂਦੀਆਂ ਸੀਗੀਆ ਪਰ ਇਹ ਜਿਹੜੀਆਂ ਪੁਰਾਣੀਆਂ ਫੋਟੋਆਂ ਇਹ ਭਾਵਨਾਤਮਕ ਮੁੱਲ ਵੀ ਆਪਾਂ ਨੂੰ ਦਰਸਾਉਂਦੀਆਂ ਨੇ ਕਿਉਂਕਿ ਜਿਹੜੇ ਪੁਰਾਣੀਆਂ ਫੋਟੋ ਯਾਦਾਂ ਆਪਣੀਆਂ ਯਾਦਾਂ ਸੰਭਾਲ ਕੇ ਰੱਖਦੇ ਇਸ ਨਾਲ ਸਾਨੂੰ ਇਹ ਵੀ ਪਤਾ ਲੱ ਯ ਯਾਦਾਂ ਹਮੇਸ਼ਾ ਯਾਦ ਆਈ ਜਾਂਦੀਆਂ ਕਿ ਅਸੀਂ ਫਲਾਣੀ ਇੱਕ ਕਿਸੇ ਜਗ੍ਹਾ ਘੁੰਮਣ ਗਏ ਉੱਥੇ ਇਹ ਇਹ ਚੀਜ਼ਾਂ ਦੇਖੀਆਂ ਉਹਨਾਂ ਚੀਜ਼ਾਂ ਬਾਰੇ ਸਾਨੂੰ ਯਾਦ ਰਹਿੰਦਾ ਹਮੇਸ਼ਾ ਅਤੇ ਉਹਨਾਂ ਬਾਰੇ ਅਸੀਂ ਸਦੀਆਂ ਤੱਕ ਜਦੋਂ ਤੱਕ ਜਦੋਂ ਤੱਕ ਸਾਡੇ ਕੋਲ ਇਹ ਫੋਟੋਆਂ ਸਾਂਭੀਆਂ ਪਈਆਂ ਰਹਿਣੀਆਂ ਉਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਾਂਗੇ ਅਸੀਂ ਮੇਰੇ ਕੋਲ ਬਹੁਤ ਸਾਰੀਆਂ ਪੁਰਾਣੀਆਂ ਫੋਟੋਆਂ ਨੇ ਜਿਹਨਾਂ ਨੂੰ ਦੇਖ ਕੇ ਅਸੀਂ ਪੁਰਾਣੇ ਸਮੇਂ ਨੂੰ ਅੱਜ ਵੀ ਯਾਦ ਕਰਦੇ ਰਹਿੰਦੇ ਹਾਂ ਧੰਨਵਾਦ